ਪੰਜਾਬ ਦਾ ਜਿਹੜਾ ਵਾਤਾਵਰਨ ਹੈ ਉਹ ਜਮਾਂ ਵੀ ਪਹਿਲਾਂ ਵਰਗਾ ਨਹੀਂ ਰਿਹਾ ਬਹੁਤ ਹੀ ਤਬਦੀਲੀ ਆ ਚੁੱਕੀ ਹੈ ਪੰਜਾਬ ਦਾ ਜਿਹੜਾ ਪਹਿਲਾਂ ਵਾਤਾਵਰਨ ਹੁੰਦਾ ਸੀ ਉਹ ਬਹੁਤ ਹੀ ਸ਼ੁੱਧ ਹੁੰਦਾ ਸੀਗਾ ਬਹੁਤ ਹੀ ਸਾਫ ਹੁੰਦਾ ਸੀ ਪਹਿਲਾਂ ਤੇ ਲ ਜਮਾਨੇ ਵਿੱਚ ਵੀ ਲੋਕ ਜਮਾਂ ਵੀ ਵਹੀਕਲਾਂ ਦਾ ਬਹੁਤ ਘੱਟ ਯੂਜ ਕਰਦੇ ਸੀ ਬਹੁਤ ਘੱਟ ਇਸਤੇਮਾਲ ਕਰਦੇ ਹੁੰਦੇ ਸੀ ਜ਼ਿਆਦਾਤਰ ਤੁਰ ਕੇ ਜਾਣਾ ਜਾਂ ਸਾਈਕਲ 'ਤੇ ਪ੍ਰੈਫਰ ਕਰਦੇ ਸੀ ਜਾਣਾ ਜਿਹਦੇ ਕਰਕੇ ਉਹਨਾਂ ਦੀ ਸਿਹਤ ਵੀ ਵਧੀਆ ਰਹਿੰਦੇ ਸੀ ਤੇ ਹੁਣ ਸਮੇਂ ਦੇ ਨਾਲ ਨਾਲ ਇਤਿਹਾਸ ਵਧਿਆ ਟੈਕਨੋਲੋਜੀ ਵਧੀ ਜਿਹਦੇ ਕਰਕੇ ਲੋਕਾਂ ਨੇ ਹੁਣ ਵਹੀਕਲ ਸ਼ੁਰੂ ਕਰਦੇ ਹੈ ਆਉਣ ਜਾਣ ਦੇ ਸਾਧਨ ਲਈ ਮੋਟਰਸਾਈਕਲ ਕਾਰਸ ਲਾਈਕ ਬਾਈਕਸ ਵਗੈਰਾ ਇਹ ਸਾਰਾ ਕੁਛ ਸ਼ੁਰੂ ਕਰਤਾ ਜਿਹਦੇ ਕਰਕੇ ਪੋਲਿਊਸ਼ਨ ਬਹੁਤ ਜਿਆਦਾ ਹੋ ਰਿਹਾ ਪ੍ਰਦੂਸ਼ਣ ਬਹੁਤ ਹੀ ਜਿਆਦਾ ਫੈਲ ਚੁੱਕਿਆ ਤੇ ਜਿਵੇਂ ਅੱਜ ਕੱਲ ਦੇ ਜ਼ਮਾਨੇ 'ਚ ਲੋਕਾਂ ਨੇ ਟੈਕਨੋਲੋਜੀ ਇਨੀ ਜ਼ਿਆਦਾ ਵੱਧ ਚੁੱਕੀ ਹੈ ਕੀ ਹਰੇਕ ਕੰਮ ਮਸ਼ੀਨਰੀ ਉੱਤੇ ਕਰਤਾ ਜਿਵੇਂ ਪਹਿਲਾਂ ਤੇ ਜ਼ਮਾਨੇ 'ਚ ਕੁਝ ਤਾਂ ਨਹੀਂ ਹੁੰਦਾ ਸੀ ਲੋਕ ਜਿਹੜਾ ਵੀ ਕੰਮ ਕਰਦੇ ਸੀ ਆਪਦੇ ਹੱਥਾਂ ਨਾਲ ਕਰਦੇ ਸੀ ਜਿੰਨੀਆਂ ਵੀ ਹੁਣ ਆਹ ਫੈਕਟਰੀਆਂ ਜਿਵੇਂ ਚੱਲਦੀਆਂ ਇਹ ਸਾਰੀਆਂ ਮਤਲਬ ਸਮਾਨ ਬਣਾਉਂਦੀਆਂ ਚੀਜ਼ਾਂ ਬਣਾਉਂਦੀਆਂ ਪੈਕਟ ਵਗੈਰਾ ਇਹ ਸਾਰੀਆਂ ਫੈਕਟਰੀਆਂ ਜੋ ਚੱਲਦੀਆਂ ਇਹਨਾਂ ਚੋਂ ਜਿਹੜਾ ਧੂੰਆਂ ਨਿਕਲਦਾ ਉਹਦੇ ਕਰਕੇ ਜਿਹੜਾ ਆਪਣਾ ਵਾਤਾਵਰਨ ਹੈ ਉਹ ਕਾਫੀ ਪ੍ਰਦੂਸ਼ਿਤ ਹੋ ਚੁੱਕਿਆ ਤੇ ਪਰ ਪਹਿਲਾਂ ਦੇ ਜਮਾਨੇ 'ਚ ਇਹੋ ਜਿਹਾ ਕੁਛ ਵੀ ਨਹੀਂ ਹੁੰਦਾ ਸੀ ਸਾਰੇ ਲੋਕ ਆਪਦੇ ਹੱਥਾਂ ਨਾਲ ਕੰਮ ਕਰਦੇ ਸੀ ਜਿਹਦੇ ਨਾਲ ਵਾਤਾਵਰਨ ਬਹੁਤ ਸਾਫ ਹੁੰਦਾ ਸੀਗਾ ਤੇ ਸਭ ਸਾਰਿਆਂ ਨੂੰ ਸਾਹ ਸਾਹ ਵਗੈਰਾ ਦੀ ਵੀ ਕੋਈ ਦਿੱਕਤ ਨਹੀਂ ਆਉਂਦੀ ਸੀ ਪਰ ਹੁਣ ਦੇ ਜੇ ਜਮਾਨੇ 'ਚ ਵੇਖੀਏ ਤਾਂ ਹਰੇਕ ਦੂਜੇ ਬੰਦੇ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਹੁੰਦੀ ਹੈ ਤੇ ਅੱਜ ਕੱਲ ਜਦੋਂ ਭੁਚਾਲ ਆਉਂਦੇ ਆ ਲੋਕਾਂ ਨੇ ਇੰਨੀ ਜਿਆਦਾ ਟੈਕਨੋਲੋਜੀ ਯੂਜ ਕਰ ਚੁੱਕੇ ਆ ਵੀ ਜਦੋਂ ਵੀ ਕੋਈ ਭੁਚਾਲ ਆਉਂਦਾ ਤਾਂ ਉਹਨਾਂ ਨੂੰ ਨੁਕਸਾਨ ਹੁੰਦਾ ਉਹਨਾਂ ਦੇ ਘਰ ਬਿਲਡਿੰਗ ਸਾਰਾ ਕੁਛ ਡਿੱਗ ਪੈਂਦਾ ਜਿਹਦੇ ਕਰਕੇ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਤੇ